ਸਾਡੇ ਖੇਤਰ ਵਿੱਚ ਵੱਖ ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਜਿਵੇਂ ਹਿੰਦੀ ਪੰਜਾਬੀ ਸੰਸਕ੍ਰਿਤ ਅਤੇ ਉਰਦੂ ਸਾਡੇ ਪੰਜਾਬ ਵਿੱਚ ਪੰਜਾਬੀ ਬੋਲੀ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਇਹ ਸਾਡੀ ਮਾਂ ਬੋਲੀ ਹੈ ਜਦੋਂ ਅਸੀਂ ਇਹ ਸਾਡੇ ਆਲੇ ਦੁਆਲੇ ਵਿੱਚ ਵੀ ਸਾਨੂੰ ਪੰਜਾਬੀ ਬੋਲੀ ਜਾਂਦੀ ਹੈ ਸਾਨੂੰ ਸਾਡੀ ਬੋਲੀ 'ਤੇ ਮਾਣ ਹੈ